ਖੇਡਾਂ ਪੰਜਾਬ ਦੇ ਪੇਂਡੂ ਇਲਾਕੇ ਵਿੱਚ ਬਹੁਤ ਜ਼ਰੂਰੀ ਨੇ ਕਿਉੰਕਿ ਅੱਜ ਕੱਲ੍ਹ ਜਿਹੜਾ ਪੰਜਾਬ ਦਾ ਜਿਹੜਾ ਯੂਥ ਹੈ ਜਾਂ ਪੰਜਾਬ ਦੇ ਜਿਹੜੇ ਮੁੰਡੇ ਯੰਗਸਟਰ ਨੇ ਉਹ ਅੱਜ ਕੱਲ੍ਹ ਨਸ਼ਿਆਂ ਵੱਲ ਕਾਫੀ ਜਾ ਰਹੇ ਨੇ ਅਤੇ ਖੇਡਾਂ ਪਿੰਡਾਂ ਵਿੱਚ ਇੱਕ ਬਹੁਤ ਵਧੀਆ ਮਹੱਤਵ ਰੱਖਦੀਆਂ ਕਿਉਂਕਿ ਅਗਰ ਸਾਡਾ ਯੂਥ ਅਗਰ ਸਾਡੇ ਬੱਚੇ ਸ਼ੁਰੂ ਤੋਂ ਹੀ ਗੇਮਾਂ ਵਿੱਚ ਜਾਣਗੇ ਜਿੱਦਾਂ ਕਿ ਸਾਡੀ ਪੰਜਾਬ ਦੀ ਜਿਹੜੀ ਮੇਨ ਗੇਮ ਹੈ ਕਬੱਡੀ ਅਤੇ ਕਬੱਡੀ ਖੇਡੇਗਾ ਜੇ ਨਿਆਣਾ ਜਾਂ ਫੁੱਟਬਾਲ ਖੇਡੇਗਾ ਵੋਲੀਬੋਲ ਖੇਡੇਗਾ ਅਤੇ ਉਹਦੇ ਨਾਲ ਕੀ ਹੋਏਗਾ ਕਿ ਬੱਚਾ ਦਾ ਦਿਮਾਗ ਗੇਮ ਵੱਲ ਰਹੇਗਾ ਅਤੇ ਉਹ ਗਲਤ ਪਾਸੇ ਜਾਂ ਗਲਤ ਸੁਸਾਈਟੀ 'ਚ ਕਦੇ ਬੈਠੇਗਾ ਹੀ ਨਹੀਂ ਅਤੇ ਨਾ ਹੀ ਕੋਈ ਟਾਈਮ ਹੋਏਗਾ ਬੈਠਣ ਦਾ ਉਹ ਸਕੂਲੋਂ ਕੋਲਜੋ ਆਏਗਾ ਅਤੇ ਆਪਣੇ ਗੇਮਾਂ 'ਚ ਲੱਗ ਜਾਏਗਾ ਅਤੇ ਗੇਮਾਂ ਦਾ ਫਾਇਦਾ ਇਹ ਹੁੰਦਾ ਕਿ ਬੱਚਾ ਦਿਮਾਗੀ ਤੌਰ 'ਤੇ ਅਤੇ ਸਰੀਰ ਪੱਖੋਂ ਦੋਨਾਂ ਵੱਲੋਂ ਉਹ ਐਕਟਿਵ ਰਹਿੰਦਾ ਅਤੇ ਜਿਹਦੇ ਕਰਕੇ ਕਿ ਉਹ ਬਿਮਾਰੀਆਂ ਤੋਂ ਬਚਦਾ ਅਤੇ ਜਿਹੜੇ ਸਾਡੇ ਪੁਰਾਣੀ ਜਿਹੜੀ ਖੇਡਾਂ ਖੇਡਦੇ ਬਜ਼ੁਰਗ ਗੁੱਲੀ ਡੰਡਾ ਹੋ ਗਿਆ ਜਾਂ ਹੋਰ ਗੇਮਾਂ ਖੇਡਦੇ ਸੀਗੇ ਉਹ ਬੋਲ ਜਿਹੀ ਬਣਾ ਕੇ ਖੇਡ ਖੇਡਦੇ ਸੀ ਜਾਂ ਟੀਪੂ ਕਰਨ ਖੇਡਦੇ ਸੀਗੇ ਅਤੇ ਜਾਂ ਬਾਂਦਰ ਕਿੱਲਾ ਖੇਡਦੇ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਟਾਈਮ ਵਧੀਆ ਪਾਸ ਹੋ ਜਾਂਦਾ ਹੈ ਬੱਚੇ ਸਾਡੇ ਜਿਹੜੇ ਨੇ ਐਕਟਿਵ ਰਹਿੰਦੇ ਨੇ ਅਤੇ ਇੱਕ ਬੱਚਿਆਂ ਦਾ ਆਪਸ 'ਚ ਪਿਆਰ ਰਿਹਾ ਰਹਿੰਦਾ ਹੈ ਅਤੇ ਜਿਹਦੇ ਕਰਕੇ ਕਿ ਬੱਚਿਆਂ ਨੂੰ ਇੱਕ ਸਮਾਜ 'ਚ ਰਹਿਣਾ ਸਿੱਖ ਲੈਂਦੇ ਨੇ ਗੇਮਾਂ 'ਚ ਰਹਿ ਗੇਮਾਂ 'ਚ ਰਹਿ ਕੇ ਕਿਉੰਕਿ ਗੇਮਾਂ 'ਚ ਕੀ ਹੁੰਦਾ ਕਿ ਅਸੀਂ ਅਲੱਗ ਅਲੱਗ ਜਗ੍ਹਾ 'ਚ ਜਾ ਕੇ ਗੇਮਾਂ ਖੇਡਦੇ ਹਾਂ ਅਤੇ ਸਾਨੂੰ ਅਲੱਗ ਅਲੱਗ ਜਗ੍ਹਾਵਾਂ ਦਾ ਇਤਿਹਾਸ ਜਾਂ ਸਾਨੂੰ ਉੱਥੇ ਦੀ ਸੱਭਿਆਚਾਰ ਬਾਰੇ ਪਤਾ ਲੱਗਦਾ